ਹਰ ਇੱਕ ਦੀ ਨਿਜੀ ਜ਼ਿੰਦਗੀ ਵਿੱਚ ਆਪਣੀਆਂ ਇੱਛਾਵਾਂ ਜ਼ਰੂਰ ਹੁੰਦੀਆਂ ਹਨ ਅਤੇ ਇੱਕ ਟੀਚਾ ਜ਼ਰੂਰ ਹੁੰਦਾ ਹੈ ਇੱਕ ਟੀਚਾ ਜ਼ਰੂਰ ਮਿੱਥਿਆ ਹੁੰਦਾ ਹੈ ਜੋ ਕਿ ਉਸਦੇ ਸਾਰੀ ਜ਼ਿੰਦਗੀ ਵਿੱਚ ਉਸਦਾ ਮਕਸਦ ਹੁੰਦਾ ਹੈ ਕਿ ਇਸ ਟੀਚੇ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ ਮੇਰੀ ਜ਼ਿੰਦਗੀ ਵਿੱਚ ਮੇਰਾ ਰੋਲ ਮੋਡਲ ਇੱਕ ਮੇਰੀ ਵੱਡੀ ਭੈਣ ਹੈ ਜੋ ਕਿ ਇੱਕ ਲੋਇਰ ਹਨ ਉਹਨਾਂ ਤੋਂ ਮੈਂ ਇਹ ਸਿੱਖਿਆ ਹੈ ਕਿ ਕਿਵੇਂ ਆਪਣੀ ਜ਼ਿੰਦਗੀ ਵਿੱਚ ਬਿਨਾਂ ਡਰੇ ਬਿਨਾਂ ਰੁਕੇ ਕਿਵੇਂ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਰਸਤੇ ਵਿੱਚ ਬਹੁਤ ਹੀ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਦੇ ਹੋਏ ਵੀ ਉਹ ਕਿਵੇਂ ਅੱਗੇ ਵਧੇ ਅਤੇ ਕਿਵੇਂ ਉਹਨਾਂ ਨੇ ਆਪਣੀ ਮੰਜ਼ਿਲ ਤੱਕ ਪਹੁੰਚੇ ਉਹਨਾਂ ਦੇ ਇ ਇਹ ਜਜ਼ਬੇ ਨੂੰ ਦੇਖ ਕੇ ਮੇਰੇ ਅੰਦਰ ਵੀ ਇੱਕ ਪ੍ਰੇਰਨਾ ਪੈਦਾ ਹੋਈ ਹੈ ਕਿ ਜੇਕਰ ਇੱਕ ਉਹ ਇਨਸਾਨ ਕਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਮੇਰੀ ਭੈਣ ਦੇ ਚਲਾਏ ਹੋਏ ਦਿਖਾਏ ਹੋਏ ਰਸਤੇ 'ਤੇ ਮੈਂ ਚੱਲਣ ਲਈ ਬਹੁਤ ਉਤਸੁਕ ਹਾਂ ਅਤੇ ਇਸ ਆਪਣੀ ਭੈਣ ਦ ਦੇ ਨਾਲ ਹੀ ਭੈਣ ਦੇ ਨਾਲ ਹੀ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਵਿੱਚ ਵੀ ਬਹੁਤ ਦਿਲਚਸਪੀ ਰੱਖਦੀ ਹਾਂ ਅਤੇ ਆਪਣੀ ਇੱਛਾਵਾਂ ਨੂੰ ਪੂਰਾ ਕਰਨ ਲਈ ਮੈਂ ਮੈਂ ਰੋਜ਼ ਹੀ ਮਿਹਨਤ ਕਰਨਾ ਜ਼ਾਰੀ ਰੱਖਾਂਗੀ